ਪੁਰਾਣੇ ਸਮਿਆਂ ਵਿੱਚ ਖੂਹ ਵਿੱਚੋਂ ਪਾਣੀ ਕੱਢਣਾ ਬਹੁਤ ਹੀ ਆਮ ਗੱਲ ਸੀ ਕਿਉਂਕਿ ਉਸ ਸਮੇਂ ਟੂਟੀਆਂ ਜਾਂ ਨਲਕੇ ਬਹੁਤ ਹੀ ਘੱਟ ਹੁੰਦੇ ਸਨ ਅਤੇ ਲੋਕ ਖੂਹਾਂ ਵਿੱਚੋਂ ਹੀ ਪਾਣੀ ਕੱਢਦੇ ਸਨ ਅਤੇ ਖੂਹਾਂ ਵਿੱਚੋਂ ਪਾਣੀ ਰੱਸਿਆਂ ਦੁਆਰਾ ਕੱਢਿਆ ਜਾਂਦਾ ਸੀ ਇਹ ਬਹੁਤ ਹੀ ਸੌਖੀ ਤਕਨੀਕ ਸੀ ਅਤੇ ਅੱਜ ਕੱਲ੍ਹ ਇਸ ਤੋਂ ਵੀ ਸੌਖੀ ਤਕਨੀਕ ਹੈ ਇਲੈਕਟਰੀਕਲ ਮੋਟਰਸ ਕਿਉਂਕਿ ਅੱਜ ਦਾ ਯੁੱਗ ਮੋਡਰਨ ਯੁੱਗ ਹੈ ਅਤੇ ਅੱਜ ਕੱਲ੍ਹ ਟ ਟੈਕਨੀਕਲ ਟੈਕਨੀਕਲ ਦੀ ਬਹੁਤ ਹੀ ਜ਼ਿਆਦਾ ਵਰਤੋਂ ਹੋਣ ਲੱਗੀ ਹੈ ਜੇਕਰ ਕਿਸੇ ਨੇ ਅੱਜ ਦੇ ਯੱਗ ਵਿੱਚ ਖੂਹ ਵਿੱਚੋਂ ਪਾਣੀ ਕੱਢਣਾ ਹੈ ਤਾਂ ਉਹ ਇਲੈਕਟਰੀਕਲ ਮੋਟਰਸ ਦੀ ਹੀ ਵਰਤੋਂ ਕਰੇਗਾ ਜਿਵੇਂ ਕਿ ਸਮਰਸੀਬਲ ਪੰਪ ਜਦੋਂ ਜਦੋਂ ਖੂਹ ਵਿੱਚੋਂ ਪਾਣੀ ਕੱਢਣਾ ਹੋਵੇ ਤਾਂ ਸਮਰਸੀਬਲ ਪੰਪ ਦਾ ਸਵਿੱਚ ਔਨ ਕਰ ਦਿੱਤਾ ਜਾਂਦਾ ਹੈ ਤਾਂ ਉਹ ਸਮਰਸੀਬਲ ਪੰਪ ਪਾਈਪਾਂ ਰਾਹੀਂ ਖੁਦ ਹੀ ਪਾਣੀ ਉੱਪਰ ਲੈ ਆਉਂਦਾ ਹੈ ਅਤੇ ਮਨੁੱਖ ਨੂੰ ਕੋਈ ਵੀ ਜ਼ਿਆਦਾ ਖੇਚਲ ਨਹੀਂ ਕਰਨੀ ਪੈਂਦੀ